ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਐਕਚੁਲੀ ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੇ ਰੈਸਟੋਰੈਂਟ ਹੈ ਢਾਬੇ ਹੈ ਜਿਹਨਾਂ ਪਰ ਤੁਹਾਨੂੰ ਬੈਸਟ ਕੁਐਲਿਟੀ ਖਾਣੇ ਨੂੰ ਮਿਲੂੰਗੀ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਵੀ ਕੇ ਐੱਫ ਸੀ ਕੇ ਐੱਫ ਸੀ ਦੇ ਬਰਗਰ ਵੀ ਬਹੁਤ ਮਸ਼ਹੂਰ ਹੈ ਐੱਫ ਏ ਕੇ ਐੱਫ ਸੀ ਦੇ ਨੋਨ ਵੈੱਜ ਵਗੈਰਾ ਵੀ ਬਹੁਤ ਮਸ਼ਹੂਰ ਹੈ ਉਸ ਤੋਂ ਬਾਅਦ ਤੁਸੀਂ ਕਟਾਣੀ ਢਾਬੇ ਦੇ ਵਿੱਚ ਜਲੇਬੀਆਂ ਹੈ ਜਿਹੜੀਆਂ ਕਟਾਣੀ ਢਾਬੇ ਦੀ ਜਲੇਬੀਆਂ ਫੇਮਸ ਹੈ ਔਰ ਭੈਣਾਂ ਦਾ ਢਾਬਾ ਹੈ ਸੱਤ ਫੇਸ ਵਿੱਚ ਭੈਣਾਂ ਦੇ ਢਾਬੇ ਵਿੱਚੋਂ ਤੁਸੀਂ ਸੌ ਰੁਪਏ 'ਚ ਜਿੰਨਾ ਮਰਜ਼ੀ ਖਾਓ ਵਧੀਆ ਕੁਆਲਿਟੀ ਦਾ ਖਾਣਾ ਮਿਲਦਾ ਹੈ ਤੁਹਾਨੂੰ ਉੱਥੇ ਵੀ ਔਰ ਡੋਮੀਨੋਸ ਪੀਜ਼ਾਜ ਡੋਮੀਨੋਸ ਪੀਜ਼ੇ ਲਈ ਸੈਂਟਰ ਖੁੱਲ੍ਹੇ ਹੋਏ ਹਨ ਬਹੁਤ ਸਾਰੇ ਉੱਥੇ ਸਾਨੂੰ ਡੋਮੀਨੋਜ਼ ਬੈਸਟ ਕੁਆਲਿਟੀ ਜਿਹੜੀ ਕਿ ਡੋਮੀਨੋਜ਼ ਦਾ ਟੇਸਟ ਹੈ ਉਹ ਤੁਹਾਨੂੰ ਉੱਥੇ ਪੀਜ਼ਾ ਮਿਲੂੰਗਾ ਹੋਰ ਵੀ ਬਹੁਤ ਸਾਰੇ ਹੈ ਜਿਸ ਤਰ੍ਹਾਂ ਕਿ ਹੈ ਅਹ ਅਤੇ ਬਾਬੇ ਦਾ ਢਾਬਾ ਹੋ ਗਿਆ ਉੱਥੇ ਤੁਹਾਨੂੰ ਪੰਜਾਬੀ ਪੰਜਾਬੀ ਮਿਲੂੰਗਾ ਹਾਂਜੀ ਔਰ ਬੇਬੇ ਦਾ ਢਾਬਾ ਹੋ ਗਿਆ ਧੀਆਂ ਦਾ ਢਾਬਾ ਵੀ ਹੈਗਾ ਹੈ ਇੱਕ ਮੋਹਾਲੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਢਾਬੇ ਹੈ ਬਲੈਕ ਲੋਟਸ ਢਾ ਸੈਫ਼ਰੋਨ ਢਾਬਾ ਹੈ ਮਤਲਬ ਕਿ ਤੁਹਾਨੂੰ ਬਹੁਤ ਸਾਰੇ ਇੱਕ ਚਾਈਨੀਜ਼ ਵਾਲਾ ਵੀ ਢਾਬਾ ਹੈ ਉੱਥੇ ਤੁਹਾਨੂੰ ਬਹੁਤ ਸਾਰੇ ਖਾਣਿਆਂ ਨੂੰ ਮਿਲੂੰਗੇ ਜੇ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਠੀਕ